ਹੈਲੋ ਹਾਂਜੀ ਤੁਸੀਂ ਓਕੇ ਹੋਰ ਕਿੱਦਾਂ ਵਧੀਆ ਤੁਸੀਂ ਦੱਸੋ ਕਿੱਦਾਂ

ਉਸ ਟਾਈਮ ਨੂੰ ਬੱਚਿਆਂ ਨੂੰ ਮੀਨਸ ਕਿ ਬਹੁਤ ਜ਼ਿਆਦਾ ਕੋਵਿਡ ਦੇ ਟਾਈਮ ਮੀਨਜ ਮਤਲਬ ਕਿ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀਗਾ ਉਹਨਾਂ ਦੀ ਜਿਹੜੀ ਸਟਡੀ ਸੀਗੀ ਸਾਰੀ ਫੋਨ ਪਰ ਹੀ ਹੋ ਗਈ ਸੀਗੀ ਉਹਨਾਂ ਨੂੰ ਫੋਨ ਉਹਨਾਂ ਨੂੰ ਮੀਨਜ਼ ਕਿ ਫੋਨ ਵਿੱਚ ਮੀਨਜ਼ ਕਿ ਜ਼ਿਆਦਾ ਟਾਈਮ ਫੋਨ ਚਲਾਉਣਾ ਜਾਂ ਕਿ ਜੂਮ ਪਰ ਕਲਾਸਸ ਲੱਗਦੀਆਂ ਸੀਗੀਆਂ ਉਹਨਾਂ ਨਾਲ ਮੀਨਸ ਕਿ ਉਹਨਾਂ ਦੀ ਆਈਜ਼ 'ਤੇ ਬਹੁਤ ਜ਼ਿਆਦਾ ਮੀਨਜ਼ ਕਿ ਅਕ ਅਸਰ ਪਿਆ ਹੋਰ ਉਹਨਾਂ ਨੂੰ ਇਸ ਤਰ੍ਹਾਂ ਉਹਨਾਂ ਨੂੰ ਬਹੁਤ ਜ਼ਿਆਦਾ ਇਹਦੇ ਨੁਕਸਾਨ ਹੋਏ ਮੀਨਜ਼ ਕਿ ਸਾਰਾ ਟਾਈਮ ਘਰਾਂ ਹੀ ਰਹਿੰਦੇ ਅਤੇ ਮੀਨਜ਼ ਕਿ ਉਹਨਾਂ ਨੇ ਘਰਾਂ ਬੈਠ ਕੇ ਪੇਪਰ ਦਿੱਤੇ ਮੀਨਜ਼ ਕਿ ਜ਼ਿਆਦਾ ਉਹਨਾਂ ਨੂੰ ਨੋਲਜ ਵੀ ਨਹੀਂ ਰਹੀ ਉਸ ਬਾਰੇ

ਹਾਂਜੀ ਅੱਗੇ ਮੀਨਜ਼ ਕਿ ਉਹਨਾਂ ਦਾ ਉਹਨੇ ਰਿਜ਼ਲਟ ਆ ਗਏ ਮੀਨਜ਼ ਕਿ ਜਿ ਜਿਹੜੇ ਸਟੂਡੈਂਟ ਵਧੀਆ ਸੀਗੇ ਉਹਨਾਂ ਦੇ ਤਾਂ ਮਾਰਕਸ ਪੁਰਾਣੇ ਹੀ ਲੱਗੇ ਸੀਗੇ ਮੀਨਜ਼ ਕਿ ਉਹਨਾਂ ਨੂੰ ਤਾਂ ਆਪਣੇ ਨੰਬਰਾਂ ਤੋਂ ਵਧੀਆ ਉਮੀਦ ਸੀਗੀ ਨਾ ਇਸ ਉਹਦੇ ਵਿੱਚ ਵੀ ਉਹਨਾਂ ਦੇ ਬਹੁਤ ਘੱਟ ਘੱਟ ਮਾਰਕਸ ਆਏ ਉਸ ਤੋਂ ਬਾਅਦ ਅੱਗੇ ਉਹਨਾਂ ਦੇ ਗ੍ਰੇਡ ਹੀ ਲੱਗੇ ਅਤੇ ਕਿਤੇ ਵੀ ਜੇ ਮੀਨਜ਼ ਕਿ ਟੈਂਨਥ ਦੇ ਪੇਪਰ 'ਚ ਵੀ ਸਿਰਫ ਗਰੇਡ ਲੱਗੇ ਦੇਖੋ ਹੁਣ ਅਸੀਂ ਕੋਈ ਵੀ ਪੋਸਟਾਂ ਭਰਦੇ ਹਾਂ ਤਾਂ ਉਹਦੇ ਵਿੱਚ ਗ੍ਰੇਡ ਵਾਲਿਆਂ ਨੂੰ ਨਹੀਂ ਚੱਕਿਆ ਜਾਂਦਾ ਹੋਰ ਤੁਸੀਂ ਦੱਸ ਦਿਉ ਤੁਹਾਡੇ ਕੀ ਵਿਚਾਰ ਨੇ ਜਿੱਦਾਂ ਕੋਵਿਡ ਨਾਈਨਟੀਨ ਵੀ ਜਿੱਦਾਂ ਕੋਵਿਡ ਨਾਈਨਟੀਨ ਵਿੱਚ ਲੋਕ ਕਾਫੀ ਜ਼ਿਆਦਾ ਬੇਰੁਜ਼ਗਾਰ ਵੀ ਹੋ ਗਏ ਸਾਰਾ ਸਿਸਟਮ ਫੋਨ ਪਰ ਹੋ ਗਿਆ ਬੇਰੁਜ਼ਗਾਰ ਕੋਲ ਤੱਕ ਪੈਸੇ ਹੀ ਨਹੀਂ ਰਹੇ ਸੀਗੇ

ਹਾਂਜੀ

ਹਾਂਜੀ ਕੋਵਿਡ ਨਾਈਨਟੀਨ ਦੇ ਨਾਲ ਜਿਵੇਂ ਕਿ ਸਾਰਾ ਕੁਝ ਬੰਦ ਹੋਣ ਦੇ ਨਾਲ ਜਿਹੜੇ ਉਹ ਵੀ ਮੀਨਜ਼ ਕਿ ਜ਼ਿਆਦਾ ਕਰ ਬੇਰੁਜ਼ਗਾਰ ਹੋ ਗਿਆ ਵਾ ਸੀਗਾ ਮੀਨਜ਼ ਕਿ ਕੋਈ ਵੀ ਕੰਮ ਕੁੰਮ ਨਹੀਂ ਸੀਗਾ ਕੋਵਿਡ ਨਾਈਨਟੀਨ ਸਾਰਾ ਲੋਕਡਾਊਨ ਲੱਗ ਗਿਆ ਵਾ ਸੀਗਾ ਨਾ ਮਤਲਬ ਉਹਨਾਂ ਦਾ ਪੜ੍ਹਾਈ ਬੇਸਿਕ ਬਹੁਤ ਜ਼ਿਆਦਾ ਨੁਕਸਾਨ ਹੋਇਆ ਮਤਲਬ ਉਹਨਾਂ ਨੂੰ ਮੀਨਜ਼ ਕਿ ਉਹ ਨਹੀਂ ਰਹੀ ਜ਼ਿਆਦਾ ਨੌਲੇਜ ਨਹੀਂ ਰਹੀ ਉਸ ਚੀਜ਼ ਦੇ ਬਾਰੇ ਹਾਂਜੀ ਥੈਂਕ ਯੂ ਓਕੇ